ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਮੈਂ ਤੁਹਾਡੇ ਨਾਲ ਇਹ ਗੱਲ ਕਰਨਾ ਚਾਹੁੰਦਾ ਕਿ ਮੇਰਾ ਜਨਮ ਦਿਨ ਇੱਕ ਜੁਲਾਈ ਦੋ ਹਜ਼ਾਰ ਤੇਈ ਨੂੰ ਆ ਰਿਹਾ ਹੈ ਅਤੇ ਮੈਂ ਤਕਰੀਬਨ ਦੁਪਹਿਰ ਬਾਰ੍ਹਾਂ ਵਜੇ ਦੇ ਬਾਅਦ 'ਚ ਆਪਣੇ ਦੋਸਤਾਂ ਨੂੰ ਪਾਰਟੀ ਕਰਨਾ ਚਾਹੁੰਦਾ ਹਾਂ ਤਾਂ ਮੈਂ ਚਾਹੁੰਦਾ ਹਾਂ ਕਿ ਉਸ ਵਕਤ ਟੇਬਲਾਂ ਦੀ ਰਿਜ਼ਰਵੇਸ਼ਨ ਬਾਰੇ ਮੈਨੂੰ ਜਾਣਕਾਰੀ ਦੇ ਦਿੱਤੀ ਜਾਵੇ ਤਾਂ ਕਿ ਮੇਰੇ ਦੋਸਤਾਂ ਦੇ ਆਉਣ ਦੇ ਸਮੇਂ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਜੇਕਰ ਪਰੇਸ਼ਾਨੀ ਆਵੇਗੀ ਤਾਂ ਸਾਰਾ ਮਾਹੌਲ ਖਰਾਬ ਵੀ ਹੋ ਸਕਦਾ ਹੈ ਇਸ ਲਈ ਤੁਸੀਂ ਮੈਨੂੰ ਪਹਿਲਾਂ ਹੀ ਸੂਚੀਆਂ ਉਹ ਦਿਖਾ ਦਿਓ ਜਿਹੜੀਆਂ ਜਿਹੜੀਆਂ ਰਿਜ਼ਰਵ ਹੋ ਚੁੱਕੀਆਂ ਨੇ ਤਾਂ ਕਿ ਮੈਂ ਉਹਨਾਂ ਨੂੰ ਆਪਣੀ ਪਾਰਟੀ ਦੇ ਸਕਾਂ